ਹੈਲੋ ਹਾਂਜੀ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੋਲਜ ਤਾਂ ਜੀ ਇੱਥੇ ਮਤਲਬ ਤਕਰੀਬਨ ਵਧੀਆ ਹੀ ਕੋਲਜ ਹੈ ਤੁਸੀਂ ਮਤਲਬ ਕਿਹੜਾ ਕੋਲਜ ਚਾਹੁੰਦੇ ਸਰਕਾਰੀ ਪ੍ਰਾਈਵੇਟ ਅਤੇ ਕਿਹੜੀ ਸਟਰੀਮ ਅੱਛਾ ਬੀਕੌਮ 'ਚ ਅੱਛਾ ਬੀਕੌਮ 'ਚ ਐਡਮਿਸ਼ਨ ਲੈਣੀ ਹੈ ਤੁਹਾਨੂੰ ਕਈ ਕੋਲਜ ਮਿਲਜੁਗੇ ਜਿੱਦਾਂ ਕਿ ਗੌਰਮੈਂਟ ਕੋਲਜ ਐੱਸ ਡੀ ਕੋਲਜ ਹੋਰ ਡੀ ਏ ਵੀ ਕੋਲਜ ਇਹਨਾਂ ਸਾਰਿਆਂ 'ਚ ਬੀਕੌਮ ਹੈਗੀ ਆ ਸਰਕਾਰੀ ਜਿਹੜੇ ਮੈਂ ਦੱਸ ਰਿਹਾ ਤੁਹਾਨੂੰ ਅਤੇ ਉੱਦਾਂ ਇਹਨਾਂ ਦੀ ਫ਼ੀਸ ਉਹ ਹੀ ਦਸ ਬਾਰ੍ਹਾਂ ਹਜ਼ਾਰ ਹੋਣੀ ਮੇਰੇ ਹਿਸਾਬ ਨਾਲ ਹਾਂਜੀ ਨਹੀਂ ਨਹੀਂ ਸਾਲ ਹੂੰ ਹੂੰ ਪ੍ਰਾਈਵੇਟ ਹੈਗਾ ਰਿਆਤ ਬਹਾਰਾ ਵਾ ਹੋਰ ਆਪਣਾ ਇੱਕ ਹੈਗਾ ਰਿਆਤ ਬਹਾਰਾ ਅਤੇ ਇੱਕ ਜੀ ਐੱਨ ਏ ਮਿਲਜੂਗਾ ਇਨ੍ਹਾਂ ਦੀ ਫ਼ੀਸ ਇਨ੍ਹਾਂ ਦੀ ਮਹਿੰਗੀ ਹੋਣੀ ਜੀ ਫ਼ੀਸ ਇਹਨਾਂ ਦੀ ਹੋਣੀ ਲੱਖ ਕੁ ਨੂੰ ਹੋਣੀ ਹੈ ਤ ਲੱਖ ਤੋਂ ਪੰਜਾਹ ਸੱਠ ਹਜ਼ਾਰ ਲੱਖ ਦੇ ਲਾਗੇ ਸ਼ਾਗੇ ਡੀ ਏ ਵੀ ਕੋਲਜ ਆਪਣਾ ਪੈ ਜਾਂਦਾ ਇਸਲਾਮਾਬਾਦ 'ਚ ਐੱਸ ਡੀ ਪੈ ਜਾਂਦਾ ਰੇਲਵੇ ਮੰਡੀ ਵੱਲ ਹੈ ਐਗਜੈਕਟਲੀ ਨਹੀਂ ਪਤਾ ਮੈਨੂੰ ਬੱਟ ਉੱਥੇ ਕਿਤੇ ਹੈ ਗੌਰਮੈਂਟ ਕੋਲਜ ਹੈ ਗੌਰਮੈਂਟ ਕੋਲਜ ਚੌਂਕ ਹੈ ਸਟੇਰੀ ਰੋਡ 'ਤੇ ਕਿਸੇ ਤੋਂ ਪੁੱਛ ਲਿਓ ਉਨ੍ਹਾਂ ਨੇ ਦੱਸ ਦੇਣਾ ਰਿਆਤ ਬਹਾਰਾ ਪੈ ਜਾਂਦਾ ਤੁਹਾਡਾ ਆਪਣਾ ਉੱਥੇ ਚੰਡੀਗੜ੍ਹ ਰੋਡ 'ਤੇ ਅਤੇ ਜੀ ਐੱਨ ਏ ਤੁਹਾਡਾ ਦੇ ਕੋਲ ਪੈ ਜਾਂਦਾ ਜਲੰਧਰ ਜਾਂਦੇ ਜਾਂਦੇ ਹਾਂਜੀ ਹਾਂਜੀ ਮਿਲਜੂਗੀ ਹੋਸਟਲ ਮਿਲਜੂਗੇ ਜੀ ਨਾਲ ਹੀ ਜਿਹੜੇ ਕੋਲਜ ਦੇ ਹੋਣੇ ਪੀ ਜੀ ਵਗੈਰਾ ਤਾਂ ਥੋੜ੍ਹੇ ਦੂਰ ਹੀ ਮਿਲੂਗੇ ਦੇਖੋ ਪੀ ਜੀ ਤਾਂ ਤੁਸੀਂ ਆਪ ਹੀ ਲੈਣੇ ਹੁੰਦੇ ਦੇਖੋ ਜੀ ਕੰਡੀਸ਼ਨ ਠੀਕ ਹੁੰਦੀ ਹੋਸਟਲਾਂ ਦੀ ਵਧੀਆ ਹੀ ਕਹਿ ਲਓ ਮਤਲਬ ਇੰਨੇ ਮਾੜੇ ਨਹੀਂ ਹੁੰਦੇ ਮਤਲਬ ਰਹਿਣ ਲਾਇਕ ਹੁੰਦੇ ਆ ਘਰ ਵਰਗੀ ਰੀਸ ਤਾਂ ਨਹੀਂ ਹੁੰਦੀ ਚਲੋ ਹੂੰ ਫ਼ੀਸ ਆਪਣੀ ਇਹਨਾਂ ਦੀ ਹੋਊਗੀ ਹੋਸਟਲਾਂ ਦੀ ਸੱਤ ਅੱਠ ਹਜ਼ਾਰ ਹੋਊਗੀ ਮੇਰੇ ਖਿਆਲ ਨਾਲ ਮਹੀਨੇ ਦੀ

ਮੈਂ ਮੈਂ ਭਾਅ ਜੀ ਗੌਮੈਂਟ ਕੋਲਜ ਤੋਂ ਹਾਂਜੀ ਮਾਹੌਲ ਵਧੀਆ ਹਾਂਜੀ ਜੀ ਹਾਂਜੀ ਹਾਂਜੀ ਤੁਸੀਂ ਬੀਕੌਮ ਕਰਨੀ ਆ ਬੀਕੌਮ ਤਾਂ ਬੈਟਰ ਆ ਜੀ ਤੁਸੀਂ ਗੌਰਮੈਂਟ ਕੋਲਜ ਤੋਂ ਹੀ ਕਰੋ ਬੈਟਰ ਹੈ ਉਹ ਜੇ ਤਾਂ ਅਪਲਾਈ ਕਰੇ ਪਹਿਲਾਂ ਸਵਾਮੀ ਸਰਵਾਨੰਦ ਗਿਰੀ ਪੀ ਯੂ ਕੈਂਪਸ ਸਰਕਾਰੀ ਤੋਂ ਜੇ ਉੱਥੇ ਨਹੀਂ ਮਿਲਦੀ ਐਡਮਿਸ਼ਨ ਫਿਰ ਪ੍ਰਾਈਵੇਟ 'ਚ ਲੈ ਲਵੇ ਇੱਥੇ ਨਹੀਂ ਤਾਂ ਬਾਹਰ ਕਿਤੇ ਜਾਂ ਤਾਂ ਸਾਲ ਹੀ ਡ੍ਰੌਪ ਕਰ ਲਵੇ ਮੇਰੇ ਹਿਸਾਬ ਨਾਲ ਬਟ ਅਪਲਾਈ ਕਰੇਗੀ ਉੱਥੇ ਮਿਲ ਜਾਵੇ ਸਮ ਸਵਾਮੀ ਸਰਵਾਨੰਦ ਗਿਰੀ 'ਚ ਮਤਲਬ ਉਹ ਤਾਂ ਇਹ ਸੋਚੇ ਕਿ ਮਤਲਬ ਸਵਾਮੀ ਸਰਵਾਨੰਦ ਗਿਰੀ 'ਚ ਹੀ ਮਿਲ ਜਾਵੇ ਐਡਮਿਸ਼ਨ ਕੋਸ਼ਿਸ਼ ਇਹ ਕਰੇ ਹਾਂਜੀ ਓਕੇ ਬਾਈ ਜੀ ਬਾਏ ਹਾਂਜੀ ਹਾਂਜੀ ਉੱਧਰ ਤਾਂ ਜੀ ਹਾਂਜੀ ਠੀਕ ਹੈ ਬਾਈ ਜੀ ਓ ਓਕੇ